ਮੈਂ ਤੁਹਾਨੂੰ ਭੰਗੜੇ ਦੇ ਕੁਛ ਸਟੈਪਾਂ ਬਾਰੇ ਦੱਸਣਾ ਚਾਹੁੰਦਾ ਹਾਂ ਜੁੰਡੀ ਬਾਹਾਂ ਨੂੰ ਉੱਪਰ ਕਰਕੇ ਹੱਥਾਂ ਨੂੰ ਮੋੜਦੇ ਹੋਏ ਖੜਕਾਉਣਾ ਡੁੱਲੀ ਇੱਕ ਪੈਰ ਨੂੰ ਅੱਗੇ ਅਤੇ ਪਿੱਛੇ ਲਿਜਾ ਕੇ ਨੱਚਣਾ ਪਿੰਡਾਂ ਗੋਡਿਆਂ ਨੂੰ ਥੋੜ੍ਹਾ ਝੁਕਾ ਕੇ ਹੱਥਾਂ ਨੂੰ ਮੋੜਦੇ ਹੋਏ ਦਰਾਏ ਨਾਲ ਨੱਚਣਾ ਲੂੰਦੀ ਇੱਕ ਹੱਥ ਨੂੰ ਹਵਾ ਵਿੱਚ ਝੁਲਾਉਣਾ ਅਤੇ ਦੂਜੇ ਹੱਥ ਨੂੰ ਖੜਕਾਉਣਾ ਥਾਪਾ ਪੈਰਾਂ ਨਾਲ ਮਜ਼ਬੂਤੀ ਨਾਲ ਧਰਤੀ ਨੂੰ ਮਾਰਦੇ ਹੋਏ ਨੱਚਣਾ ਧੰਨਵਾਦ ਜੀ